ਹੈਲੋ ਹੈਲੋ ਮੈਂ ਯਾਦਵਿੰਦਰ ਸਿੰਘ ਆਪਣਾ ਪ੍ਰੈੱਸ ਰਿਪੋਰਟਰ ਬੋਲ ਰਿਹਾ ਅੱਛਾ ਤੁਹਾਡੇ ਇੱਥੇ ਮਤਲਬ ਵੀ ਐਜੂਕੇਸ਼ਨ ਦਾ ਅਤੇ ਬਾਕੀ ਕੀ ਮਾਹੌਲ ਹੈ ਕੀ ਸਿਸਟਮ ਹੈ ਤੁਹਾਡੇ ਇੱਥੇ ਐਜੂਕੇਸ਼ਨ ਵਗੈਰਾ ਕਿਵੇਂ ਚੱਲ ਰਹੀ ਹੈ ਸਕੂਲ ਤੁਹਾਡੇ ਇੱਥੇ ਕਿੰਨੇ ਸਕੂਲ ਨੇ ਕਿੱਥੋਂ ਬੋਲ ਰਹੇ ਹੋ ਤੁਸੀਂ ਸ਼ੁਭ ਨਾਮ ਕੀ ਹੈ ਤੁਹਾਡਾ ਅੱਛਾ ਅਤੇ ਤੁਹਾਡਾ ਮਤਲਬ ਵੀ ਆਪਣਾ ਖੇਤਰ ਦੇ ਵਿੱਚ ਐਜੂਕੇਸ਼ਨ ਦਾ ਅਤੇ ਡਿਵੈਲਪਮੈਂਟ ਦਾ ਮਤਲਬ ਕਿੱਦਾਂ ਦਾ ਹੈਗਾ ਕੀ ਚੱਲ ਰਿਹਾ ਤੁਹਾਡੇ ਇੱਥੇ ਡਿਵੈਲਪ ਐਜੂਕੇਸ਼ਨ ਦਾ ਦੱਸੋ ਸਭ ਤੋਂ ਪਹਿਲਾਂ ਕਿੰਨੇ ਸਕੂਲ ਨੇ ਟੀਚਰ ਪੂਰੇ ਆ ਸਕੂਲਾਂ ਦੇ ਵਿੱਚ ਅੱਛਾ ਗਰਲ ਸਕੂਲ ਅਲੱਗ ਹੈ ਬੋਏ ਸਕੂਲ ਅਲੱਗ ਹੈ ਗਰਲ ਸਕੂਲ ਦੇ ਵਿੱਚ ਕਿੰਨੇ ਮਤਲਬ ਟੀਚਰ ਹੈਗੇ ਨੇ ਟੀਚਰ ਪੂਰੇ ਨੇ ਅੱਛਾ ਜੀ ਐਜੂਕੇਸ਼ਨ ਦੇ ਮਤਲਬ ਉਹਨਾਂ ਦਾ ਜਿਹੜੇ ਦੂਜੀ ਆਪਣਾ ਨਾਲ ਦੀ ਨਾਲ ਕੋਈ ਗੇਮ ਵਗੈਰਾ ਦਾ ਕਿੱਦਾਂ ਦਾ ਹੈਗਾ ਸਿਸਟਮ ਬੱਚੇ ਬੱਚਿਆਂ ਨੂੰ ਮਤਲਬ ਜਿਹੜੇ ਬੱਚੇ ਨੇ ਬੱਚਿਆਂ ਨੂੰ ਸ਼ਾਇਦ ਜਿਹੜੇ ਬੱਚੇ ਨੇ ਉਹਨਾਂ ਨੂੰ ਵਧੀਆ ਪੜ੍ਹਾ ਰਹੇ ਨੇ ਗੇਮਾਂ ਦੀ ਵੀ ਜਾਗਰਿਤ ਕੀਤਾ ਜਾਂਦਾ ਇਹ ਤੁਸੀਂ ਗਰਲ ਸਕੂਲ ਦੀ ਗੱਲ ਕਰ ਰਹੇ ਹੋ ਕਿ ਬੋਆਏ ਸਕੂਲ ਦੀ ਗੱਲ ਕਰ ਰਹੇ ਹੋ ਦੋਨਾਂ ਦਾ ਹੀ ਅੱਛਾ ਮਤਲਬ ਵੀ ਦੋਨਾਂ ਦਾ ਹੀ ਖੇਤਰ ਅੱਛਾ ਮਤਲਬ ਵਧੀਆ ਹੈਗਾ ਬਿਲਡਿੰਗਾਂ ਕਿੱਦਾਂ ਹੈਗੀਆਂ ਬਿਲਡਿੰਗਾਂ ਤਾਂ ਅੱਜ ਕੱਲ੍ਹ ਮੇਰੇ ਹਿਸਾਬ ਨਾਲ ਆਪਣਾ ਸਮਾਰਟ ਸਕੂਲ ਹੀ ਬਣ ਗਏ ਹੈ ਨਾ ਵਧੀਆ ਬਿਲਡਿੰਗਾਂ ਹੋ ਗਈਆਂ ਬੱਚਿਆਂ ਦੀ ਸਟਰੈਂਥ ਵਧੀਆ ਆ ਜਿਹੜੇ ਬੱਚੇ ਮਤਲਬ ਵੀ ਆਪਣਾ ਥੋੜ੍ਹੇ ਜਿਹੇ ਗਰੀਬ ਘਰ ਦੇ ਬੱਚੇ ਨੇ ਉਹਨਾਂ ਲਈ ਵੱਧ ਧਿਆਨ ਦਿੱਤਾ ਜਾਂਦਾ ਵਧੀਆ ਉਹਨਾਂ ਦਾ ਮਤਲਬ ਵੀ ਉਹਨਾਂ ਦਾ ਵਧੀਆ ਰਿਸਪੋਂਸ ਦੇ ਦੇ ਰਹੇ ਨੇ ਉਹ ਵੈਰੀ ਵੈਰੀ ਗੁਡ ਵੈਰੀ ਗੁਡ ਵੈਰੀ ਗੁਡ ਚਲੋ ਅੱਛੀ ਗੱਲ ਹੈ ਬਹੁਤ ਵਧੀਆ ਜੀ ਵਿਕਾਸ ਖੇਤਰ ਦੇ ਵਿੱਚ ਜਿਹੜਾ ਵਿਕਾਸ ਵਗੈਰਾ ਜਿਹੜਾ ਹੋਰ ਮਤਲਬ ਵੀ ਤੁਹਾਡੇ ਉਹ ਕਿੱਦਾਂ ਹੋ ਰਿਹਾ ਕਿਵੇਂ ਹੈ ਅੱਛਾ ਮਤਲਬ ਵੀ ਅੱਛਾ ਮਤਲਬ ਦੂਜਿਆਂ ਨਾਲੋਂ ਠੀਕ ਹੈ ਵੈਸੇ ਥੋੜ੍ਹਾ ਜਿਹਾ ਮਤਲਬ ਵੀ ਥੋੜ੍ਹਾ ਜਿਹਾ ਧੀਮੀ ਗਤੀ 'ਚ ਚੱਲ ਰਿਹਾ ਮਤਲਬ ਹੋ ਨਹੀਂ ਰਿਹਾ ਪ੍ਰੋਪਰ ਅੱਛਾ ਓਕੇ ਬਸ ਇਹੀ ਪਤਾ ਕੀ ਗੱਲ ਹੈ ਇਹੀ ਮੈਂ ਨਾ ਤੁਹਾਡੇ ਤੋਂ ਇਹੀ ਜਾਣਕਾਰੀ ਲੈਣੀ ਸੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਥੈਂਕ ਯੂ ਗੱਲ ਕਰਨ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਯੂ ਸਰ